ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਬੋਲੋ ਹਾਂਜੀ ਦੱਸੋ

ਪੰਜਾਬੀ ਜੁੱਤੀ ਖਰੀਦਣਾ ਚਾਹੁੰਦੇ ਹੋ ਤੁਸੀਂ ਸਰ ਤੁਹਾਨੂੰ ਪੰਜਾਬੀ ਜੁੱਤੀ ਨਾ ਦਰਬਾਰ ਸਾਹਿਬ ਦੇ ਲਾਗਿਓ ਮਿਲੇਗੀ ਉੱਥੇ ਨਾ ਪੂਰੀ ਮਾਰਕੀਟ ਹੈਗੀ ਜੇ ਉੱਥੇ ਤੁਹਾਨੂੰ ਪੂਰੇ ਵਾਜਿਬ ਰੇਟਾਂ ਦੇ ਵਿੱਚ ਵੀ ਮਿਲ ਜਾਏਗੀ ਚੰਗੀ ਚੀਜ਼ ਮਿਲੇਗੀ ਨਾਲੇ ਇਸ ਤੋਂ ਇਲਾਵਾ ਤੁਹਾਨੂੰ ਪਿੰਕ ਪਲਾਜ਼ਾ ਵੀ ਤੁਸੀਂ ਜਾ ਸਕਦੇ ਜੇ ਪਿੰਕ ਪਲਾਜ਼ਾ ਦੀ ਮਾਰਕੀਟ ਬੜੀ ਅੱਛੀ ਬਣੀ ਹੋਈ ਹੈ ਹਾਂਜੀ ਉੱਥੇ ਵੀ ਤੁਹਾਨੂੰ ਰੇਟ ਸਰ ਜੈਨੂਅਨ ਰੇਟਾਂ 'ਚ ਮਿਲੇਗੀ ਚੀਜ਼ ਹਾਂਜੀ ਹਾਂਜੀ ਸਰ ਥੈਂਕ ਯੂ ਜੀ